ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਜੀ ਮੈਮ ਜੀ ਜੀ ਮੈਮ ਦੱਸੋ ਜੀ ਦੱਸੋ ਜੀ ਮੈਮ ਜਰੂਰ ਓਕੇ ਜੀ ਓਕੇ ਠੀਕ ਹੈ ਠੀਕ ਹੈ ਜੀ ਬਣ ਜਾਏਗੀ ਜੀ

ਪ੍ਰਾਈਜ਼ ਜੀ ਦੇਖੋ ਜੀ ਚਲੋ ਬਾਜ਼ਾਰ ਵਿੱਚ ਜੋ ਵੀ ਰੇਟ ਚੱਲ ਰਿਹਾ ਤੁਹਾਨੂੰ ਕੋਈ ਦਸ ਰੁਪਏ ਲਾ ਦਿਆਂਗੇ ਕਿਉਂਕਿ ਤੁਹਾਡੇ ਘਰ ਚਲੋ ਹੁਣ ਫੰਕਸ਼ਨ ਹੈਗਾ ਤੁਹਾਨੂੰ ਥੋੜਾ ਜਿਆਦਾ ਮਾਤਰਾ ਵਿੱਚ ਚਾਹੀਦਾ ਸਮਾਨ

ਨਹੀਂ ਦੇਖੋ ਚਲੋ ਠੀਕ ਹੈ ਉਹ ਤਾਂ ਜਿਵੇਂ ਅਸੀਂ ਡਰਾਈ ਫਰੂਟ ਵਗੈਰਾ ਵੀ ਕੁਝ ਐਡ ਕਰਾਂਗੇ ਤੇ ਮਿੱਠਾ ਮਿੱਠਾ ਵਗੈਰਾ ਤੁਸੀਂ ਇਹ ਤੁਸੀਂ ਆਪਦੀ ਪਸੰਦ ਦੇਖ ਸਕਦੇ ਓ ਵੀ ਕਈ ਲੋਕ ਜਿਵੇਂ ਗੁੜ ਵਗੈਰਾ ਪਵਾ ਲੈਂਦੇ ਐ ਕਈ ਖੰਡ ਪਵਾ ਲੈਂਦੇ ਆ ਕਿਉਕੀ ਅੱਜ ਕੱਲ ਸਰਦੀ ਦਾ ਮੌਸਮ ਚੱਲ ਰਿਹਾ ਕੁਛ ਲੋਕ ਜਿਵੇਂ ਖੰਡ ਨਾਲੋਂ ਜਿਆਦਾ ਗੁੜ ਨੂੰ ਪਹਿਲ ਦਿੰਦੇ ਆ ਤਾਂ ਉਹ ਤੁਸੀਂ ਹਾਂ ਠੀਕ ਹੈ ਜੀ ਕੋਈ ਗੱਲ ਨੀ ਅੱਜਕੱਲ ਤਾਂ ਵੈਸੇ ਵੀ ਚਲੋ ਮਿੱਠਾ ਹਰ ਕੋਈ ਠੀਕ ਠਾਕ ਹੀ ਖਾਂਦਾ ਤੇ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਕੋਈ ਗੱਲ ਨਹੀਂ ਉਹ ਤਾਂ ਚਲੋ ਹੁਣ ਸਾਨੂੰ ਪਤਾ ਹੀ ਆ ਵੀ ਖਜੂਰਾਂ ਵਿੱਚ ਪਹਿਲਾਂ ਹੀ ਮਿੱਠਾ ਹੁੰਦਾ ਤੇ ਉਹ ਜੇ ਅਸੀਂ ਪਾਵਾਂਗੇ ਤਾਂ ਉਹਨੂੰ ਵੇਖ ਕੇ ਵੀ ਜੋ ਵੀ ਗੁੜ ਦੀ ਮਾਤਰਾ ਉਹਦੇ ਹਿਸਾਬ ਨਾਲ ਹੀ ਵਿੱਚ ਮਲਾਈ ਜਾਏਗੀ ਠੀਕ ਹੈ ਜੀ ਠੀਕ ਹੈ ਜੀ ਇੱਕ ਡੱਬਾ ਦੇਖੋ ਜੀ ਲਗਭਗ ਲਗਭਗ ਤਿੰਨ ਸੋ ਰੁਪਏ ਕਿਲੋ ਦਾ ਡੱਬਾ ਹੋਏਗਾ ਹਾਂਜੀ ਕਿਉਂਕਿ ਉਹਦੇ ਵਿੱਚ ਦੇਖੋ ਵੀ ਅਸੀਂ ਕਾਜੂ ਬਦਾਮ ਜਾਂ ਜੋ ਵੀ ਕਿਸ਼ਮਿਸ਼ ਜੋ ਵੀ ਡਰਾਈ ਫਰੂਟ ਹੈ ਤੇ ਤੁਹਾਨੂੰ ਪਤਾ ਹੀ ਆ ਫਿਰ ਉਹਨਾਂ ਦੀ ਵੀ ਪਿੱਛ ਲੱਗੇ ਕਿ ਕੀਮਤ ਤੇ ਵੀ ਹਾਂ ਹਾਂ ਬਾਕੀ ਜੋ ਉਹਦੀ ਆਪਾਂ ਗੁਣਵੱਤਾ ਜਿਹਨੂੰ ਆਪਾਂ ਕੁਆਲਿਟੀ ਬੋਲਦੇ ਆਂ ਵੀ ਉਹਦੇ ਨਾਲ ਵੀ ਆਪਾਂ ਕੋਈ ਉਹ ਸਮਝੌਤਾ ਨਹੀਂ ਕਰਨਾ ਹੈਗਾ ਵੀ ਤੁਹਾਨੂੰ ਉਹ ਬਹੁਤ ਵਧੀਆ ਮਿਲੇਗੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਸ ਚੀਜ਼ ਦਾ ਪੂਰਾ ਧਿਆਨ ਰੱਖਿਆ ਜਾਏਗਾ ਹਾਂਜੀ ਕਿਉਂਕਿ ਦੇਖੋ ਤੁਸੀਂ ਵੀ ਹਾਂ ਠੀਕ ਹੈ ਜੀ ਠੀਕ ਆ ਜੀ ਜਿਵੇਂ ਤੁਹਾਡਾ ਸਮਾਨ ਤਿਆਰ ਹੋਏਗਾ ਅਸੀਂ ਤੁਹਾਨੂੰ ਕਾਲ ਕਰ ਦਿਆਂਗੇ ਠੀਕ ਹ ਜੀ ਤੇ ਤੁਸੀਂ ਆਪਦਾ ਲੈ ਸਕਦੇ ਹੋ ਸਮਾਨ ਤੁਸੀਂ ਪੰਜਾਹ ਦੇ ਬੋਲਿਆ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਸਾਰੀਆਂ ਚੀਜ਼ਾਂ ਦਾ ਈ ਧਿਆਨ ਰੱਖਿਆ ਜਾਏਗਾ ਦੇਖੋ ਜੀ ਤੁਸੀਂ ਤੁਹਾਡੇ ਘਰ ਫੰਕਸ਼ਨ ਹੋ ਰਿਹਾ ਤੇ ਤੁਸੀਂ ਅਗਾਹਾਂ ਦੇਣੇ ਆ ਡੱਬੇ ਦੇਖੋ ਜੇ ਅਸੀਂ ਆਪਦੇ ਵੱਲੋਂ ਪੂਰਾ ਸਾਫ ਸਫਾਈ ਦਾ ਜਾਂ ਅਸੀਂ ਕੁਆਲਿਟੀ ਦਾ ਧਿਆਨ ਰੱਖਾਂਗੇ ਤਾਂ ਅਗਲਾ ਬੰਦੇ ਨੂੰ ਵੀ ਸਾਡੀ ਪਸੰਦ ਆਏਗੀ ਨਾ

ਜੀ ਮੈਮ ਜੀ ਜੀ ਜੀ ਕੰਮ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਮਿਲੇਗਾ ਇਸ ਤਰ੍ਹਾਂ ਵੀ ਕਿਸੇ ਵੱਲੋਂ ਕਿਸੇ ਵੀ ਚੀਜ਼ ਦੀ ਮਤਲਬ ਕਮੀ ਰਹਿਗੀ ਹੋਵੇ ਤਾਂ ਹਰੇਕ ਚੀਜ਼ ਦਾ ਕੁਆਲਿਟੀ ਵਜੋਂ ਸਾਫ ਸਫਾਈ ਵਜੋਂ ਜਾਂ ਜੋ ਡੱਬੇ ਵੀ ਹੈ ਥੋਨੂੰ ਵਧੀਆ ਵਧੀਆ ਤਰੀਕੇ ਨਾਲ ਉਹਨਾਂ ਨੂੰ ਮਿਠਾਈ ਵਿੱਚ ਭਰ ਕੇ ਤੇ ਹਾਂਜੀ ਹਾਂਜੀ ਉੱਪਰੋਂ ਵਧੀਆ ਪੈਕਿੰਗ ਤੁਹਾਨੂੰ ਮਿਲੇਗੀ ਬਿਲਕੁਲ ਜੀ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਅਗਾਹ ਡੱਬੇ ਦੇਓਗੇ ਹਰ ਕੋਈ ਮਤਲਬ ਪੁੱਛੇਗਾ ਤੁਹਾਨੂੰ ਵੀ ਤੁਸੀਂ ਕਿੱਥੋਂ ਬਨਵਾਈ ਹੈ ਮਿਠਾਈ

ਜੀ ਮੈਮ ਹਾਂਜੀ ਹਾਂਜੀ ਬਿਲਕੁਲ ਮੈਮ ਬਿਲਕੁਲ ਜੀ ਠੀਕ ਹ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਸਤਿ ਸ੍ਰੀ ਅਕਾਲ ਜੀ